ਨਹੀਂ ਇੱਥੇ ਦੇ ਖੇਡ ਟੂਰਨਾਮੈਂਟ ਜਾਂ ਸਪੋਰਟਸ ਜੋ ਵੀ ਹੈਗਾ ਆ ਉਹ ਸਿਆਸੀ ਸਮੂਹ ਜਾਂ ਸੰਗਠਨ ਵੱਲੋਂ ਨਹੀਂ ਕੀਤਾ ਜਾਂਦਾ ਇਹ ਸਾਰੇ ਪ੍ਰਬੰਧ ਜਿਹੜੇ ਆ ਡਿਪਾਰਟਮੈਂਟ ਆਫ ਸਪੋਰਟਸ ਜਿਹੜਾ ਗੌਰਮੈਂਟ ਆਫ ਪੰਜਾਬ ਦਾ ਉਹਨਾਂ ਰਾਹੀਂ ਕੀਤੇ ਜਾਂਦੇ ਨੇ ਉਹੀ ਸਪੋਰਟਸ ਪਰਸਨਸ ਜਿਹੜੇ ਹੁੰਦੇ ਆ ਸਪੋਰਟਸਮੈਨ ਸਪੋਰਟਸ ਵੂਮੈਨ ਉਹਨਾਂ ਦੀ ਇਹ ਜ਼ਰੂਰਤਾਂ ਦਾ ਖਾਸ ਧਿਆਨ ਰੱਖਦੇ ਹਨ ਉਹੀ ਗ੍ਰਾਮ ਪੰਚਾਇਤ ਦੇ ਜਿਹੜੇ ਹੁੰਦੇ ਨੇ ਉਹਨਾਂ ਨਾਲ ਸੰਪਰਕ ਕਰਕੇ ਸਟੇਡੀਅਮ ਵਗੈਰਾ ਬਣਵਾਉਂਦੇ ਨੇ ਪਿੰਡਾਂ ਦੇ ਵਿੱਚ ਅਤੇ ਟੂਰਨਾਮੈਂਟ ਕਰਵਾਏ ਜਾਂਦੇ ਨੇ ਉਸ ਤੋਂ ਬਾਅਦ ਟਾਈਮ ਟੂ ਟਾਈਮ ਟੂਰਨਾਮੈਂਟ ਗੋਰਮੈਂਟ ਆਫ ਪੰਜਾਬ ਦਾ ਜਿਹੜਾ ਸਪੋਰਟਸ ਡਿਪਾਰਟਮੈਂਟ ਹੈ ਉਹ ਕਰਵਾਉਂਦਾ ਰਹਿੰਦਾ ਆ ਹੁਣ ਔਰ ਬਾਹਰੋਂ ਵਿਜਿਟ ਕਰਨ ਵਾਲੀਆਂ ਸਟੇਟਸ ਦੇ ਜਿਹੜੇ ਖਿਡਾਰੀ ਆਉਂਦੇ ਨੇ ਇੱਥੇ ਉਹਨਾਂ ਵਾਸਤੇ ਵੀ ਖਾਸ ਬੰਦੋਬਸਤ ਕੀਤੇ ਜਾਂਦੇ ਨੇ ਉਹਨਾਂ ਨੂੰ ਉਹ ਵੀ ਟੂਰਨਾਮੈਂਟ ਇੱਥੇ ਖੇਡਣ ਆਉਂਦੇ ਨੇ ਮੈਚ ਖੇਡਣ ਆਉਂਦੇ ਨੇ